ਵੈਸੇ ਤਾਂ ਮੇਰੇ ਬਹੁਤ ਮਨਪਸੰਦ ਸ਼ਬਦ ਹਨ ਮੈਨੂੰ ਇੱਕ ਸ਼ਬਦ ਬਹੁਤ ਪਸੰਦ ਹਾਂਂ ਪਸੰਦ ਹੈ ਸਤਿਨਾਮ ਵਾਹਿਗੁਰੂ ਇਹ ਸ਼ਬਦ ਜਦੋਂ ਮੈਂ ਮੁਸ਼ਕਿਲ ਵਿੱਚ ਹੁੰਦੀ ਹਾਂ ਜਾਂ ਦੁੱਖੀ ਹੁੰਦੀ ਹਾਂ ਮੇਰੇ ਮਨ ਮੇਰੇ ਮੂੰਹ ਵਿੱਚੋਂ ਆਪਣੇ ਆਪ ਨਿੱਕਲ ਜਾਂਦਾ ਹੈ ਇਹ ਸ਼ਬਦ ਮੇਰੇ ਮਨ ਨੂੰ ਸ਼ਾਤ ਕਰਦਾ ਹੈ ਅਤੇ ਮੈਨੂੰ ਦੁੱਖ ਸਹਾਰਨ ਦੀ ਹਿੰਮਤ ਦਿੰਦਾ ਹੈ ਅਤੇ ਇ ਮੈਨੂੰ ਇੱਕ ਤੁੱਕ ਬਹੁਤ ਵਧੀਆ ਲੱਗਦੀ ਹੈ ਤੇਰਾ ਭਾਣਾ ਮਿੱਠਾ ਲਾਗੈ ਇਸ ਤੁੱਕ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਕੋਈ ਵੀ ਮੁਸ਼ਕਿਲ ਜਾ ਦੁੱਖ ਹੋਵੇ ਤੁਸੀਂ ਉਸ ਨੂੰ ਮਿੱਠੇ ਨਾਲ਼ ਲੈਣਾ ਹੈ